ਜੇਕਰ ਗੱਲ ਕੀਤੀ ਜਾਵੇ ਤਾਂ ਹਾਲੇ ਤੱਕ ਵੀ ਮੈਂ ਕੋਈ ਵੀ ਗੀਤ ਨਾ ਹੀ ਤਾਂ ਮੈਂ ਕੋਈ ਗੀਤ ਰਿਕਾਰਡ ਕੀਤਾ ਹੈ ਅਤੇ ਨਾ ਹੀ ਮੈਂ ਕੋਈ ਗੀਤ ਪੇਸ਼ ਕੀਤਾ ਹੈ ਪ੍ਰੰਤੂ ਜੇਕਰ ਅੱਗੇ ਕੰਮ ਵਧੀਆ ਰਿਹਾ ਤਾਂ ਮੈਂ ਆਉਣ ਵਾਲ਼ੇ ਸਮੇਂ ਦੇ ਵਿੱਚ ਜ਼ਰੂਰ ਇੱਕ ਨਵਾਂ ਗੀਤ ਪੇਸ਼ ਕਰਾਂਗਾ ਜਿਸ ਨੂੰ ਮੈਂ ਰਿਕਾਰਡ ਕਰਾਂਗਾ ਅਤੇ ਸਭ ਨੂੰ ਸੁਣਾਵਾਂਗਾ ਉਮੀਦ ਕਰਦਾ ਹਾਂ ਉਹ ਗੀਤ ਸਭ ਨੂੰ ਪਸੰਦ ਆਵੇਗਾ ਅਤੇ ਗੀਤਾਂ ਦੀ ਗੱਲ ਕਰੀਏ ਤਾਂ ਗੀਤ ਬਹੁਤ ਸਾਰੇ ਹਨ ਪ੍ਰੰਤੂ ਮੈਂ ਆਪਣੇ ਤਰੀਕੇ ਨਾਲ਼ ਕੋਈ ਆਪਣਾ ਸੱਭਿਆਚਾਰ ਸਾਫ ਦਾ ਗੀਤ ਲੈ ਕੇ ਆਵਾਂਗਾ ਅਤੇ ਤੁਹਾਡੇ ਸਾਹਮਣੇ ਪੇਸ਼ ਕਰਾਂਗਾ